ਸਾਡੇ ਖੇਤਰ ਵਿੱਚ ਮੁੱਖ ਮੀਡੀਆ ਜਾਂ ਮਨੋਰੰਜਨ ਉਦਯੋਗ ਦਾ ਮੁੱਖ ਸ੍ਰੋਤ ਓ ਟੀ ਟੀ ਪਲੈਟਫਾਰਮ ਨੇ ਵੈਬ ਚੈਨਲਸ ਨੇ ਅੱਜ ਦੇ ਸਮੇਂ ਵਿੱਚ ਲੋਕਾਂ ਕੋਲ ਐਨਾ ਟਾਈਮ ਨਹੀਂ ਹੁੰਦਾ ਕਿ ਉਹ ਲੋਕਾਂ ਨੂੰ ਲੋਕਾਂ ਨਾਲ਼ ਜਾ ਕੇ ਬਾਹਰ ਥਿਏਟਰ ਵਿੱਚ ਫਿਲਮ ਦੇਖਣ ਇਸ ਕਰਕੇ ਉਹਨਾਂ ਨੇ ਆਪਣੇ ਫੋਨ 'ਤੇ ਹੀ ਓ ਟੀ ਟੀ ਪਲੈਟਫਾਰਮ ਦੀ ਸਬਸਕ੍ਰਿਪਸ਼ਨ ਲਈ ਹੋਈ ਹੈ ਅਤੇ ਉਹ ਜਦੋਂ ਵੀ ਉਹਨਾਂ ਨੂੰ ਟਾਈਮ ਲੱਗਦਾ ਹੈ ਉਹ ਉਸ 'ਤੇ ਹੀ ਫਿਲਮਾਂ ਵਗੈਰਾ ਜਾਂ ਕੁਛ ਵੀ ਦੇਖ ਸਕਦੇ ਹਨ ਹਾਲੀ ਦੇ ਸਾਲ ਵਿੱਚ ਇਹ ਬਹੁਤ ਬਦਲਿਆ ਹੈ ਕਿਉਂਕਿ ਫਿਲਮ ਦੇ ਜੋ ਡਾਇਰੈਕਟਰ ਪ੍ਰੋਡਿਊਸਰ ਵਗੈਰਾ ਹਨ ਉਹ ਵੀ ਥਿਏਟਰ ਵਿੱਚ ਆਪਣੀ ਫਿਲਮ ਰਿਲੀਜ਼ ਕਰਨ ਤੋਂ ਸੰਕੋਚ ਕਰਦੇ ਹਨ ਅਤੇ ਉਹ ਓ ਟੀ ਟੀ ਪਲੈਟਫਾਰਮ 'ਤੇ ਹੀ ਵੈੱਬ ਸੀਰੀਜ਼ ਜਾਂ ਫਿਰ ਫਿਲਮਾਂ ਫਿਲਮਾਂ ਨੂੰ ਦੇਖਣਾ ਦਿਖਾਉਣਾ ਪਸੰਦ ਕਰਦੇ ਹਨ